ਅਗਰ ਕਿਸੇ ਕੰਮ ਵਾਲੀ ਥਾਂ 'ਤੇ ਵਿਵਾਦ ਜਾਂ ਮੁਸ਼ਕਿਲ ਦਾ ਸਾਹਮਣਾ ਕਰਦੇ ਹਾਂ ਤਾਂ ਫਿਰ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਸਮਝਦਾਰੀ ਨਾਲ ਕੰਮ ਕਨ ਲਈਏ ਕਿਉਂਕਿ ਅਗਰ ਸਮਝਦਾਰੀ ਨਹੀਂ ਦਿਖਾਵਾਂਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇ ਮੰਨ ਲਓ ਸਾਡਾ ਕਿਸੇ ਨਾਲ ਝਗੜਾ ਹੋ ਗਿਆ ਤਾਂ ਸਾਨੂੰ ਉਹਦੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਉਹਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਇੱਦਾਂ ਨਹੀਂ ਹੋਣਾ ਓਦਾਂ ਨਹੀਂ ਹੋਣਾ ਜਾਂ ਫਿਰ ਉਹਨੂੰ ਉਹਦੀ ਗੱਲ ਸੁਣਨੀ ਚਾਹੀਦੀ ਹੈ ਕਿ ਕੀ ਪਤਾ ਸਾਡੀ ਆਪਣੀ ਉਹ ਗਲਤੀ ਹੋਵੇ ਅਸੀਂ ਨਹੀਂ ਸੁਣ ਸੁਣਦੇ ਹੋਵੈ ਉਹਦੇ ਤੋਂ ਸੋ ਫਿਰ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਦੀ ਵੀ ਉਹਦੀ ਵੀ ਸੁਣੀਏ ਅਤੇ ਆਪਣੀ ਵੀ ਸੁਣਾਈਏ ਫਿਰ ਦੇਖੀਏ ਕਿਸ ਕਿਹਦੀ ਗੱਲ ਸਹੀ ਹੈ ਕਿਹਦੀ ਗਲਤ ਹੈ ਅਤੇ ਉਹਦੇ ਬਾਅਦ ਹੀ ਫੈਸਲਾ ਲਈਏ ਅਤੇ ਜੇ ਅਗਰ ਅਗਲਾ ਬੰਦਾ ਨਹੀਂ ਮੰਨ ਰਿਹਾ ਤਾਂ ਫਿਰ ਆਪਣੇ ਸੀਨੀਅਰ ਨਾਲ ਜਾਂ ਫਿਰ ਆਪਣੇ ਆਪ ਤੋਂ ਵੱਡੇ ਨਾਲ ਉਹਦੀ ਗੱਲ ਕਰਾ ਦੇਈਏ ਤਾਂ ਜੋ ਉਹਨੂੰ ਸਮਝਾਵੇ ਕਿਉਂਕਿ ਵੱਡਿਆਂ ਦਾ ਤਾਂ ਫਿਰ ਸੁਣਨੀ ਹੋਈ ਪੈਂਦੀ ਹੈ ਅਤੇ ਇਸ ਤਰ੍ਹਾਂ ਅਸੀਂ ਕਿਸੇ ਗੱਲ ਦਾ ਮਸਲਾ ਕਰ ਸਕਦੇ ਹਾਂ ਅਤੇ ਜੇ ਮੁਸ਼ਕਿਲ ਸਥਿਤੀ ਆਉਂਦੀ ਹੈ ਤਾਂ ਉਹਨੂੰ ਆਪਣੀ ਸਮਝਦਾਰੀ ਨਾਲ ਸ਼ਾਂਤ ਦਿਮਾਗ ਨਾਲ ਠੰਡੇ ਦਿਮਾਗ ਨਾਲ ਬੈਠ ਕੇ ਥੋੜ੍ਹਾ ਟਾਈਮ ਲੈ ਕੇ ਸਮਝ ਕੇ ਫਿਰ ਉਹਨੂੰ ਸੋਲਵ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਅਸੀਂ ਆਪਣੇ ਕੰਮ ਵਾਲੀ ਥਾਂ 'ਤੇ ਜੋ ਵਿਵਾਦ ਨੇ ਮੁਸ਼ਕਿਲ ਸਥਿਤੀਆਂ ਆਉਂਦੀਆਂ ਉਹਨਾਂ ਤੋਂ ਨਜਿੱਠ ਸਕਦੇ ਹਾਂ